ਪੰਜਾਬੀ ਭਾਸਾ ਦੇ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਗੁਰੂਆ ਪੀਰਾਂ ਦੀ ਧਰਤੀ ਅਖਵਾਈ ਜਾਂਦੀ ਹੈ ਅਤੇ ਇਸ ਧਰਤੀ 'ਤੇ ਗੁਰੂਆ ਪੀਰਾਂ ਦੇ ਵੇਲੇ ਤੋਂ ਹੀ ਜੋ ਭਗਤ ਹੋਏ ਨੇ ਉਨ੍ਹਾ ਨੇ ਜੋ ਆਪਣੀ ਲਿਖਤ ਲਿਖੀ ਹੈ ਉਹ ਗੁਰਮੁਖੀ ਵਿੱਚ ਹੀ ਲਿਖੀ ਹੈ ਅਤੇ ਇਹ ਭੇ ਭਾਸ਼ਾ ਸਾਡੀ ਗੁਰੂਆ ਪੀਰਾਂ ਦੇ ਵੇਲੇ ਤੋਂ ਹੀ ਤੁਰੀ ਆ ਰਹੀ ਹੈ ਅਤੇ ਦਿਨ ਪ੍ਰਤੀ ਦਿਨ ਇਸ ਭਾਸ਼ਾ ਦੇ ਵਿੱਚ ਵਿਕਾਸ ਬਹੁਤ ਹੋਇਆ ਹੈ ਇੱਕ ਸੁਲਝੀ ਹੋਈ ਭਾਸ਼ਾ ਅਤੇ ਸਾਡੀ ਪਹਿਚਾਣ ਬਣੀ ਹੋਈ ਹੈ